ਹੈਲੋ

ਹੈਲੋ ਹਾਂਜੀ ਪ੍ਰੀਤਇੰਦਰ ਗੱਲ ਕਰ ਰਹੇ ਹੋ ਬਾਈ

ਹੈਲੋ ਹਾਂਜੀ ਪ੍ਰੀਤਇੰਦਰ ਗੱਲ ਕਰ ਰਹੇ ਹੋ ਵੀਰੇ ਵੀਰੇ ਆਪਾਂ ਨਾ ਨੰਬਰ ਲਿਆ ਸੀ ਤੁਹਾਡਾ ਆਪਣੇ ਫਰੈਂਡ ਤੋਂ ਅਤੇ ਅਪ ਆਪਣੇ ਕੋਲ ਨਾ ਫਰਨੀਚਰ ਸੀਗਾ ਪੁਰਾਣਾ ਸੋਫਾ ਮੇਰੇ ਕੋਲ ਅਤੇ ਆਪਾਂ ਨਾ ਕੋਠੀ ਪਾ ਲਈ ਅਤੇ ਕੋਠੀ ਦੇ ਵਿੱਚ ਸ਼ਿਫਟ ਹੋ ਗਏ ਸੀ ਅਤੇ ਮੇਰੇ ਕੋਲ ਸੋਫਾ ਪੁਰਾਣਾ ਪਿਆ ਉਹ ਮੈਂ ਥੋੜ੍ਹਾ ਜਿਹਾ ਰੈਨੋਵੇਟ ਕਰਾਉਣਾ ਤੁਹਾਡੇ ਤੋਂ ਵੀ ਉਹ ਪਤਾ ਨਾ ਲੱਗੇ ਪੁਰਾਣਾ ਆਪਾਂ ਮਤਲਬ ਉਹ ਕਰ ਲੈਂਦੇ ਹੋ ਤੁਸੀਂ ਰੈਨੋਵੇਟ ਕਰਾਉਣਾ ਉਹ ਕਰ ਦੋਂਗੇ ਠੀਕ ਹੈ ਅਤੇ ਉਹ ਨਾ ਹਾਂ ਉਹ ਮੈਂ ਤੁਹਾਨੂੰ ਦੱਸ ਦੂੰਗਾ ਪਤਾ ਕੀ ਕਰਾਂਗੇ ਆਪਾਂ ਪਹਿਲਾਂ ਤਾਂ ਉਹ ਸੋਫੇ ਦੀਆਂ ਮੈਂ ਪਿਕਚਰ ਵਟਸਐਪ ਕਰੂੰਗਾ ਤੁਹਾਨੂੰ ਠੀਕ ਹੈ ਉਹ ਤੁਸੀਂ ਆਪੇ ਚੈੱਕ ਕਰ ਲਿਓ ਵੀ ਉਹ ਕਿਸ ਤਰ੍ਹਾਂ ਦਾ ਡਿਜ਼ਾਇਨ ਹੈ ਅਤੇ ਫਿਰ ਉਹਦੇ 'ਤੇ ਇੱਕ ਤਾਂ ਆਪਾਂ ਕੱਪੜਾ ਚੇਂਜ ਕਰਾਵਾਂਗੇ ਉਹਦਾ ਠੀਕ ਹੈ ਜੀ ਅਤੇ ਇੱਕ ਉਹਦਾ ਡਿਜ਼ਾਇਨ ਚੇਂਜ ਕਰ ਦਾਂਗੇ ਆਪਾਂ ਵੀ ਪਤਾ ਹੀ ਨਾ ਲੱਗੇ ਆਪਾਂ ਨੂੰ ਵੀ ਪੁਰਾਣਾ ਸੀਗਾ ਠੀਕ ਹੈ ਤੇ ਨਵਾਂ ਨਿਕਲ ਆਉਗਾ ਉਹ ਗੱਦੀ ਵਗੈਰਾ ਦੇਖ ਲਾਂਗੇ ਜਿਹੜੀ ਚੇਂਜ ਹੋਣ ਵਾਲੀ ਹੋਈ ਉਹਨੂੰ ਚੇਂਜ ਕਰ ਦਾਂਗੇ ਜਿਹੜੀ ਨਹੀਂ ਹੋਈ ਉਹ ਰਹਿਣ ਦਾਂਗੇ ਠੀਕ ਹੈ ਗੱਦੀ ਵਧੀਆ ਲਾਵਾਂਗੇ ਆਪਾਂ ਸਲੀਪ

ਨਹੀਂ ਨਹੀਂ ਠੀਕ ਹੈ ਮੈਮ ਮੈਨੂੰ ਆਂਂਏ ਦੱਸੋ ਮਾੜਾ ਜਿਹਾ ਰੇਟ ਕੀ ਚੱਲਦਾ ਪਰ ਮੀਟਰ ਜਾਂ ਕੀ ਰੇਟ ਚੱਲਦਾ ਆਪਣਾ ਕਿੰਨੇ ਰੁਪਏ ਪਰ ਮੀਟਰ ਹੈ

ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਨਾ ਐਂਹੀ ਕਰਦਾ ਪਤਾ ਕੀ ਮੈਂ ਨਾ ਹੁਣ ਇਸ ਨੰਬਰ 'ਤੇ ਤੁਹਾਨੂੰ ਵਟਸਐਪ ਕਰ ਰਿਹਾ ਆਪਣੀਆਂ ਫੋਟੋਆਂ ਸੋਫੇ ਦੀਆਂ ਅਤੇ ਕੀ ਕਰਾਂਗੇ ਤੁਸੀਂ ਮਾੜਾ ਜਿਹਾ ਆਪਦੇ ਮਨ 'ਚ ਵੇਖ ਲਿਓ ਡਿਜ਼ਾਇਨ ਕੀ ਸੈੱਟ ਹੁੰਦਾ ਸੋਟ ਅੋਫ ਡਿਜ਼ਾਇਨ ਮੈਨੂੰ ਵਟਸਐਪ ਕਰ ਦਿਓ ਅਤੇ ਕੁਛ ਕੱਪੜਾ ਮੈਂ ਆ ਕੇ ਸਿਲੈਕਟ ਕਰ ਲੂ ਤੁਹਾਡੀ ਦੁਕਾਨ 'ਤੇ ਠੀਕ ਹੈ ਜੀ

ਬਿਲਕੁਲ ਬਿਲਕੁਲ ਮੈਂ ਫੋਟੋਆਂ ਭੇਜਦਾ ਅਤੇ ਬਾਕੀ ਆਪਾਂ ਸ਼ੋਪ 'ਤੇ ਗੱਲ ਕਰ ਲਾਂਗੇ ਓਕੇ ਵੀਰੇ ਓਕੇ ਜੀ ਓਕੇ ਓਕ